ਭਾਰਤ ਦੇਸ਼ ਵਿੱਚ ਭਾਰਤੀ ਪੁਰਾਣੇ ਸਮੇਂ ਵਿੱਚ ਲੋਕ ਗੀਤ ਦਾ ਆਨੰਦ ਮਾਣਿਆ ਕਰਦੇ ਸਨ ਸਾਰੇ ਗਲੀ ਮਹੱਲੇ ਦੇ ਬਜ਼ੁਰਗ ਨੌਜਵਾਨ ਬੱਚੇ ਅਤੇ ਔਰਤਾਂ ਇਕੱਠੀਆਂ ਹੋ ਕੇ ਗੀਤ ਗਾਇਆ ਕਰਦੀਆਂ ਸਨ ਅਤੇ ਉਹ ਵੱਖਰੇ ਵੱਖਰੇ ਇੰਸਟਰੂਮੈਂਟਸ ਨੂੰ ਯੂਜ ਕਰਕੇ ਆਪਣਾ ਪ੍ਰਗਟਾਵਾ ਕਰਦੇ ਸਨ ਅਤੇ ਬਹੁਤ ਜ਼ਿਆਦਾ ਆਨੰਦ ਮਾਣਿਆ ਕਰਦੇ ਸਨ ਉਹ ਸਾਰੀ ਚੀਜ਼ਾਂ ਦੀ ਜਗ੍ਹਾ ਅੱਜ ਕੱਲ੍ਹ ਮੋਬਾਈਲ ਅਤੇ ਟੈਲੀਵਿਜ਼ਨ ਨੇ ਲੈ ਲੈ ਲਈ ਹੈ ਅੱਜ ਕੱਲ੍ਹ ਲੋਕ ਬਾਹਰ ਜਾਣਾ ਘੱਟ ਪਸੰਦ ਕਰਦੇ ਸਨ ਉਹਦੀ ਵਜ੍ਹਾ ਇਹ ਵੀ ਹੈ ਕਿ ਲੋਕ ਆਪਣੇ ਕੰਮਾਕਾਰਾਂ ਵਿੱਚ ਬਹੁਤ ਜ਼ਿਆਦਾ ਰੁੱਝੇ ਹੋਏ ਹਨ ਉਹਨਾਂ ਕੋਲ ਇੰਨਾਂ ਟਾਈਮ ਨਹੀਂ ਹੈ ਕਿ ਉਹ ਸਾਰੇ ਇਕੱਠੇ ਹੋ ਕੇ ਗੱਲਾਂ ਬਾਤਾਂ ਕਰ ਸਕਣ ਅਤੇ ਮਨੋਰੰਜਨ ਕਰ ਸਕਣ ਸੋ ਇਸ ਕਰਕੇ ਉਹ ਅੱਜ ਕੱਲ੍ਹ ਦੇ ਗੀਤ ਸੁਣਨੇ ਜ਼ਿਆਦਾ ਪਸੰਦ ਕਰਦੇ ਸਨ ਕਿਉਂਕਿ ਉਹ ਆਪਣੇ ਘਰਾਂ ਵਿੱਚ ਬੈਠ ਕੇ ਸਪੀਕਰਾਂ 'ਤੇ ਗਾਣੇ ਲਗਾ ਕੇ ਸੁਣ ਲੈਂਦੇ ਹਨ ਅਤੇ ਆਪਣਾ ਮਨੋਰੰਜਨ ਕਰ ਲੈਂਦੇ ਹਨ ਪੁਰਾਣੇ ਸਮੇਂ ਵਾਲੀ ਗੱਲ ਅੱਜ ਨਹੀਂ ਰਹੀ ਪਰ ਇਹ ਵੀ ਟੈਲੀਵਿਜ਼ਨ 'ਤੇ ਗਾਣੇ ਸੁਣਨਾ ਵੀ ਅਤੇ ਫਿਲਮਾਂ ਦੇਖਣੀਆਂ ਵੀ ਅੱਜ ਕੱਲ੍ਹ ਦਾ ਮਨੋਰੰਜਨ ਬਣ ਚੁੱਕਾ ਹੈ ਸੋ ਅੱਜ ਕੱਲ੍ਹ ਲੋਕ ਮਨੋਰੰਜਨ ਟੀ ਵੀ 'ਤੇ ਹੀ ਬੇ ਅਤੇ ਘਰ ਬੈਠਿਆਂ ਹੀ ਜ਼ਿਆਦਾ ਪਸੰਦ ਕਰਦੇ ਸਨ ਮੈਨੂੰ ਵੀ ਕ੍ਰਿਕਟ ਬਹੁਤ ਪਸੰਦ ਹੈ ਔਰ ਮੈਂ ਆਪਣੇ ਮਨੋਰੰਜਨ ਲਈ ਕ੍ਰਿਕਟ ਦੇਖਣ ਸਟੇਡੀਅਮ ਵਿੱਚ ਹੀ ਜਾਂਦਾ ਹਾਂ